ਪੰਜਾਬ ਵਿੱਚ ਕਾਰੋਬਾਰ ਨੂੰ ਵਿਕਾਸ ਅਤੇ ਵਿਸਥਾਰ ਕਰਨ ਦੇ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ ਜਿਵੇਂ ਕਿ ਪਹਿਲਾਂ ਪਹਿਲਾਂ ਅਸੀਂ ਕਾਰੋਬਾਰ ਵਿੱਚ ਸਾਰਾ ਕੰਮ ਆਪਣੇ ਹੱਥੀਂ ਕਰਦੇ ਸੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਕੰਮ ਅਸੀਂ ਹੁਣ ਹੋਰ ਦੂਸਰੇ ਲੋਕਾਂ ਦੀ ਮਦਦ ਦੇ ਨਾਲ ਹੋਰ ਵਧੀਆ ਅਤੇ ਜ਼ਿਆਦਾ ਕਰ ਸਕਦੇ ਹਾਂ ਫਿਰ ਇਸ ਤੋਂ ਬਾਅਦ ਆਪਣੇ ਆਪ ਨੂੰ ਆਧੁਨਿਕ ਯੁੱਗ ਦੇ ਵਿੱਚ ਸਾਰਿਆਂ ਨੂੰ ਆਉਣਾ ਪਿਆ ਔਰ ਉਸ ਦੇ ਵਿੱਚ ਆਪਾਂ ਆਨਲਾਈਨ ਇੰਟਰਨੈਟ ਔਰ ਕੰਪਿਊਟਰ ਦੀ ਮਦਦ ਦੇ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਮੋਬਾਈਲ ਨੇ ਵੀ ਸਾਡੀ ਬਹੁਤ ਮਦਦ ਕੀਤੀ ਔਰ ਪੰਜਾਬ ਦੇ ਵਿੱਚ ਕਾਰੋਬਾਰ ਨੂੰ ਆਪਾਂ ਤਰੱਕੀ 'ਤੇ ਲਿਆਉਣ ਵਾਸਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਔਰ ਪੰਜਾਬ ਇਸ ਵਕਤ ਕਾਰੋਬਾਰ ਦੇ ਵਿੱਚ ਕਾਫੀ ਵਧੀਆ ਦਿਖਾ ਰਿਹਾ ਹੈ ਔਰ ਇਸ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਹਨ ਉਹ ਵੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰ ਰਹੇ ਹਨ ਅਤੇ ਉਹਨਾਂ ਵਿੱਚ ਜਿਹੜਾ ਪ੍ਰਬੰਧਨ ਕਰਨ ਦਾ ਪ੍ਰਬੰਧ ਕਰਨ ਦਾ ਤਰੀਕਾ ਹੈ ਉਹ ਵੀ ਬਹੁਤ ਵਧੀਆ ਹੈ ਜਿਹਦੇ ਨਾਲ ਉਹ ਆਪਣਾ ਵਪਾਰ ਇੱਕ ਇੱਕ ਰਾਜ ਤੋਂ ਦੂਸਰੇ ਰਾਜ ਅਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਅਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਫੈਲਾ ਰਹੇ ਹਨ ਔਰ ਇਸ ਤਰ੍ਹਾਂ ਨਾਲ ਸਾਡਾ ਰੁਜ਼ਗਾਰ ਦਿਨੋ ਦਿਨ ਫੈਲ ਰਿਹਾ ਹੈ ਜੋ ਕਿ ਬਹੁਤ ਵਧੀਆ ਹੈ